ਵੀਹ ਮਾਰਚ ਵੀਹ ਇੱਕੀ ਸੋਲਾਂ ਜਨਵਰੀ ਉੱਨੀ ਪੰਝੱਤਰ ਇਕੱਤੀ ਮਈ ਉੱਨੀ ਇੱਕੀ ਅਠਾਰਾਂ ਅਪ੍ਰੈਲ ਵੀਹ ਬਾਈ ਅਠਾਰਾਂ ਫ਼ਰਵਰੀ ਵੀਹ ਤੇਈ